ਮੇਰੇ ਲਈ ਮੇਰੀ ਸਭ ਤੋਂ ਯਾਦਗਾਰ ਚੜ੍ਹਾਈ ਸੀ ਧਰਮਸ਼ਾਲਾ ਸ਼ਹਿਰ ਵਿੱਚ ਤਰਿਊਂਡ ਟਰੇਕ ਜਿਸ ਨੂੰ ਚੜ੍ਹਨ ਲਈ ਘੱਟੋ ਘੱਟ ਸੱਤ ਘੰਟੇ ਲੱਗਦੇ ਹਨ ਸਾਨੂੰ ਇੱਕ ਪਹਾੜੀ ਨੂੰ ਟੱਪ ਕੇ ਦੂਜੀ ਪਹਾੜੀ 'ਤੇ ਜਾਣਾ ਪੈਂਦਾ ਹੈ ਜਿਸ ਕਰਕੇ ਸਾਨੂੰ ਕਾਫੀ ਰਾਸਤੇ ਮਿਲਦੇ ਹਨ ਜੋ ਕਿ ਉਬੜ ਖਾਬੜ ਹੁੰਦੇ ਹਨ ਜਿਵੇਂ ਕਿ ਅਸੀਂ ਜਦੋਂ ਸ਼ੁਰੂ ਕੀਤਾ ਜਦੋਂ ਮੌਸਮ ਬਿਲਕੁਲ ਸਾਫ ਸੀ ਜਦੋਂ ਅਸੀਂ ਚੜ੍ਹਾਈ ਚੜ੍ਹਦੇ ਗਏ ਚੜ੍ਹਦੇੇ ਗਏ ਤਾਂ ਮੈਂ ਆਪਣੇ ਮਿੱਤਰਾਂ ਨਾਲ ਚੜ੍ਹਾਈ ਚੜ੍ਹੀ ਸੀ ਮੇਰੇ ਮਿੱਤਰ ਜੋ ਮੇਰੇ ਤੋਂ ਪਹਿਲਾਂ ਪਹੁੰਚ ਚੁੱਕੇ ਸਨ ਮੈਂ ਹੌਲ਼ੀ ਹੌਲ਼ੀ ਚੱਲ ਰਿਹਾ ਸੀ ਹੌਲ਼ੀ ਹੌਲ਼ੀ ਚੱਲਣ ਨਾਲ ਮੈਨੂੰ ਕਾਫੀ ਥਕਾਨ ਨਹੀਂ ਫੀਲ ਹੋਈ ਜ ਜੋ ਕਿ ਜੋ ਤੇਜ਼ ਚੱਲ ਰਹੇ ਸਨ ਉਹਨਾਂ ਨੂੰ ਕਾਫੀ ਥਕਾਨ ਫੀਲ ਹੋਈ ਅਤੇ ਰਸਤੇ ਜਾ ਕੇ ਜਦੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤਾਂ ਰਸਤਾ ਹੋਰ ਖਰਾਬ ਹੋ ਗਿਆ ਸੀ ਤਾਂ ਸਾਨੂੰ ਹੋਰ ਡਰ ਲੱਗਣ ਲੱਗ ਗਿਆ ਸੀ ਕਿ ਅਸੀਂ ਗਿਰ ਨਾ ਜਾਣ ਬਟ ਔਖੇ ਸੌਖੇ ਹੋ ਕੇ ਅਸੀਂ ਪੂਰੀ ਪਹਾੜੀ ਚੜ੍ਹ ਪਏ ਅਤੇ ਅਸੀਂ ਪਹੁੰਚ ਕੇ ਮੈਨੂੰ ਇਹ ਸਬਕ ਮਿਲਿਆ ਕਿ ਸਾਨੂੰ ਜਦੋਂ ਵੀ ਪਹਾੜੀ ਚੜ੍ਹਨੀ ਚਾਹੀਦੀ ਹੈ ਅਤੇ ਹੌਲ਼ੀ ਹੌਲ਼ੀ ਹੀ ਚੜ੍ਹਨੀ ਚਾਹੀਦੀ ਹੈ